ਹਾਂਜੀ ਜਿਵੇਂ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਗਾ ਇਹ ਟੈਕਨੋਲਜੀ ਆ ਇਹਦੇ ਫਾਇਦੇ ਵੀ ਹੁੰਦੇ ਨੇ ਨੁਕਸਾਨ ਵੀ ਹੁੰਦੇ ਨੇ ਜਿਵੇਂ ਇਹ ਗੱਲ ਕਰੀਏ ਕਿ ਡਾਂਸ ਯੋਗ ਨੂੰ ਕਿਵੇਂ ਪ੍ਰਭਾਵਿਤ ਕੀਤਾ ਇਸਨੇ ਡਾਂਸ ਯੋਗ 'ਤੇ ਚੰਗਾ ਪ੍ਰਭਾਵ ਵੀ ਪਿਆ ਅਤੇ ਥੋੜ੍ਹਾ ਬਹੁਤ ਮਾੜਾ ਪ੍ਰਭਾਵ ਵੀ ਪਿਆ ਚੰਗੇ ਪ੍ਰਭਾਵ ਦੀ ਗੱਲ ਕਰੀਏ ਕਿ ਜੋ ਲੋਕ ਚੰਗਾ ਡਾਂਸ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਕੋਈ ਵੀ ਪੋਸਟਾਂ ਨੇ ਪਾ ਰਹੇ ਨੇ ਉਹਨਾਂ ਨੂੰ ਪ੍ਰਮੋਸ਼ਨ ਮਿਲ ਰਹੀ ਆ ਉਹਨਾਂ ਨੂੰ ਵੇਖ ਕੇ ਹੋਰ ਵੀ ਵਧੀਆ ਡਾਂਸ ਕਰਨ ਦੇ ਚਾਹਵਾਨ ਇਛੁੱਕ ਹੋਏ ਨੇ ਪਰ ਕੁਝ ਲੋਕ ਪੁੱਠੇ ਸਿੱਧੇ ਹੱਥ ਪੈਰ ਮਾਰ ਕੇ ਉਸਨੂੰ ਡਾਂਸ ਦਾ ਨਾਂ ਦੇ ਰਹੇ ਨੇ ਹਾਲਾਂਕਿ ਉਹ ਡਾਂਸ ਨਹੀਂ ਹੈਗਾ ਉਹ ਡਾਂਸ ਦਾ ਜਲੂਸ ਕੱਢ ਰਹੇ ਨੇ ਡਾਂਸ ਦੀ ਬੇਇਜ਼ਤੀ ਕਰ ਰਹੇ ਨੇ ਅਤੇ ਜ਼ਿਆਦਾਤਰ ਲੋਕ ਉਸਨੂੰ ਵੀ ਅੱਗੇ ਪ੍ਰਫੁੱਲਿਤ ਕਰ ਰਹੇ ਨੇ ਜੋ ਕਿ ਬਹੁਤ ਗਲਤ ਹੈਗਾ ਚੰਗੀ ਚੀਜ਼ ਨੂੰ ਪ੍ਰਫੁੱਲਿਤ ਕਰਨਾ ਸੋਸ਼ਲ ਮੀਡੀਆ ਦਾ ਦੇ ਦੌਰ ਵਿੱਚ ਬਹੁਤ ਵਧੀਆ ਕੰਮ ਹੈ ਪਰ ਨਾਲ ਨਾਲ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਇਹਦੇ ਮਾੜੇ ਪ੍ਰਭਾਵ ਵੀ ਨੇ ਮਾੜੀਆਂ ਚੀਜ਼ਾਂ ਮਾੜੇ ਡਾਂਸ ਵੀ ਪ੍ਰਫੁੱਲਿਤ ਹੋ ਰਹੇ ਨੇ ਸੋ ਇਹੀ ਕਹਿ ਸਕਦੇ ਹਾਂ ਕਿ ਡਾਂਸ ਯੁੱਗ ਦੇ ਉੱਪਰ ਇਸਨੇ ਮਾੜਾ ਅਸਰ ਵੀ ਪਾਇਆ ਅਤੇ ਚੰਗਾ ਅਸਰ ਵੀ ਪਾਇਆ ਸੋ ਇਹੀ ਉਮੀਦ ਕਰਾਂਗੇ ਕਿ ਅੱਗੇ ਸੋਸ਼ਲ ਮੀਡੀਆ ਦੇ ਉੱਪਰ ਡਾਂਸ ਦੇ ਉੱਪਰ ਕੋਈ ਮਾੜਾ ਪ੍ਰਭਾਵ ਨਾ ਪਵੇ ਚੰਗੇ ਅਤੇ ਸੋਹਣੇ ਸਾਫ ਸੁਥਰੇ ਡਾਂਸ ਨੂੰ ਹੀ ਪ੍ਰਫੁੱਲਿਤ ਕੀਤਾ ਜਾਵੇ ਤਾਂ ਜੋ ਲੋਕਾਂ ਤੱਕ ਸਾਫ ਸੁਥਰੇ ਡਾਂਸ ਅਤੇ ਚੰਗੇ ਲੋਕਾਂ ਦਾ ਸੁਨੇਹਾ ਪਹੁੰਚ ਸਕੇ